ਪੰਜਾਬ ਵਿੱਚ ਕਾਰੋਬਾਰ ਚਲਾਉਣ ਅਤੇ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਈ ਤਰੀਕੇ ਨਾਲ ਕੀਤੀ ਜਾਂਦੀ ਹੈ ਤਕਨਾਲੋਜੀ ਨੇ ਕਾਰੋਬਾਰ ਦੇ ਹਰ ਖੇਤਰ ਵਿੱਚ ਇਨਕਲਾਬੀ ਬਦਲਾਅ ਲਿਆਂਦਾ ਹੈ ਜਿਵੇਂ ਕਿ ਉਤਪਾਦਨ ਵਿਕਰੀ ਮਾਰਕੀਟਿੰਗ ਅਤੇ ਪ੍ਰਬੰਧਨ ਇੱਥੇ ਕੁਝ ਮੁੱਖ ਤਰੀਕੇ ਦਿੱਤੇ ਗਏ ਹਨ ਜਿਹਨਾਂ ਨਾਲ ਪੰਜਾਬ ਦੇ ਉਦਯੋਗਪਤੀ ਤਕਨਾਲੋਜੀ ਦੀ ਵਰਤੋਂ ਕਰਦੇ ਹਨ ਮਸ਼ੀਨਰੀ ਅਤੇ ਆਟੋਮੇਸ਼ਨ ਪੰਜਾਬ ਦੇ ਵੱਖ ਵੱਖ ਉਦਯੋਗ ਜਿਵੇਂ ਕਿ ਤਾਣੇ ਬਾਣੇ ਟੈਕਸਟਾਈਲ ਖੇਤੀਬਾੜੀ ਮੈਨੂਫੈਕਚਰਿੰਗ ਵਿੱਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਉਤਪਾਦਨ ਦੀ ਗਤੀ ਅਤੇ ਕੁਆਲਿਟੀ 'ਚ ਸੁਧਾਰ ਆਇਆ ਹੈ ਆਟੋਮੇਸ਼ਨ ਜਿੱਥੇ ਮੈਨੂਅਲ ਮਿਹਨਤ ਘੱਟ ਹੁੰਦੀ ਹੈ ਅਤੇ ਮਸ਼ੀਨਾਂ ਕੰਮ ਕਰਦੀਆਂ ਹਨ ਨਾਲ ਖਰਚ ਵੀ ਘੱਟ ਹੁੰਦਾ ਹੈ ਅਤੇ ਉਤਪਾਦਨ ਵਿੱਚ ਤੀਬਰਤਾ ਵੱਧਦੀ ਹੈ ਇਹ ਕੰਮ ਦੀ ਗੁਣਵੱਤਾ ਨੂੰ ਵੀ ਨਿਰੰਤਰ ਬਣਾਈ ਰੱਖਦਾ ਹੈ ਡਿਜੀਟਲ ਮਾਰਕੀਟਿੰਗ ਪੰਜਾਬੀ ਕਾਰੋਬਾਰੀਆਂ ਨੇ ਤਕਨਾਲੋਜੀ ਦੀ ਮਦਦ ਨਾਲ ਆਪਣੇ ਉਤਪਾਦਾਂ ਦੀ ਪਹੁੰਚ ਵੱਧ ਤੋਂ ਵੱਧ ਗਾਹਕਾਂ ਤੱਕ ਬਣਾਈ ਹੈ ਇੰਟਰਨੈਟ ਅਤੇ ਸਮਾਰਟ ਫੋਨਾਂ ਦੀ ਮਦਦ ਨਾਲ ਫੇਸਬੁਕ ਇੰਸਟਾਗ੍ਰਾਮ ਅਤੇ ਯੂਟੀਊਬ ਵਰਗੇ ਪਲੇਟਫਾਰਮਾਂ 'ਤੇ ਵਿਕਰੀ ਨੂੰ ਵਧਾਇਆ ਹੈ ਈ ਕਮਰਸ ਤਕਨਾਲੋਜੀ ਦੀ ਵਰਤੋਂ ਨਾਲ ਪੰਜਾਬ ਦੇ ਵਪਾਰੀਆਂ ਨੇ ਆਪਣਾ ਕਾਰੋਬਾਰ ਔਨਲ ਔਨਲਾਈਨ ਲਿਆਂਦਾ ਹੈ ਐਮਾਜੋਨ ਫਲਿੱਪਕਾਟ ਅਤੇ ਹੋਰ ਮੋਬਾਇਲ ਐਪਸ ਵਰਗੀਆਂ ਈ ਕਮਰਸ ਸਾਈਟਾਂ 'ਤੇ ਆਪਣੇ ਉਤਪਾਦਾਂ ਨੂੰ ਵੇਚ ਕੇ ਉਹ ਪੰਜਾਬ ਦੇ ਇਲਾਕੇ ਤੱਕ ਸੀਮਤ ਨਹੀਂ ਰਹਿੰਦੇ ਇਹ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀ ਤੱਕ ਪਹੁੰਚ ਬਣਾਉਣ ਵਿੱਚ ਮਦਦ ਕਰਦਾ ਹੈ ਬਿਲਿੰਗ ਅਤੇ ਪ੍ਰਬੰਧਨ ਲਈ ਸੋਫਟਵੇਅਰ ਖੇਤੀਬਾੜੀ ਵਿੱਚ ਤਕਨਾਲੋਜੀ ਦੀ ਵਰਤੋਂ ਸੰਚਾਰ ਅਤੇ ਗਾਹਕਾਂ ਨਾਲ ਸੰਬੰਧ ਪ੍ਰਬੰਧਨ ਕਰਨਾ ਡਾਟਾ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ